ਹਾਂਜੀ ਹਾਂਜੀ ਮੈਂ ਬਸੰਤ ਕੁਮਾਰ ਹੀ ਬੋਲ ਰਿਹਾ ਹਾਂਜੀ ਹਾਂਜੀ ਹਾਂਜੀ ਪੰਜਾਬ 'ਚ ਕਾਫੀ ਜਗ੍ਹਾ ਇਹੀ ਘੁੰਮਣ ਵਾਲੀਆਂ ਮਤਲਬ ਜਿੱਥੇ ਤੁਸੀਂ ਘੁੰਮ ਸਕਦੇ ਹੋ ਇੱਕ ਤਾਂ ਜੀ ਇੱਥੇ ਸਾਡੇ ਹਾਂਜੀ ਇੱਕ ਤਾਂ ਮੇਰੇ ਵੈਸੇ ਘਰ ਦੇ ਕੋਲ ਹੀ ਇਹ ਟਿੱਬੀ ਸਾਹਿਬ ਗੁਰਦੁਆਰਾ ਜੀ ਮਤਲਬ ਕਾਫੀ ਮਸ਼ਹੂਰ ਹੈ ਜੇ ਤੁਸੀਂ ਹਾਂਜੀ ਜੇ ਤੁਸੀਂ ਇੱਥੇ ਆਉਣਾ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਮਤਲਬ ਇੱਕ ਮਤਲਬ ਜਗ੍ਹਾ ਏ ਡਿਸਟ੍ਰਿਕ ਹੈ ਜੀ ਅੰਮ੍ਰਿਤਸਰ ਉੱਥੇ ਨਾ ਸ਼੍ਰੀ ਹਰਿਮੰਦਰ ਸਾਹਿਬ ਮਤਲਬ ਜਗ੍ਹਾ ਹੈ ਗੁਰਦੁਆਰਾ ਉੱਥੇ ਸਵਰਨ ਮੰਦਿਰ ਹੈ ਜੀ ਉਹ ਮਤਲਬ ਹਾਂਜੀ ਉੱਥੇ ਦੂਰ ਦੂਰ ਤੋਂ ਲੋਕ ਆਉਂਦੇ ਪੂਰੇ ਇੰਡੀਆ ਤੋਂ ਹੀ ਤੁਸੀਂ ਉੱਥੇ ਉਹ ਜਗ੍ਹਾ ਤੁਸੀਂ ਜਾ ਸਕਦੇ ਦੇਖ ਸਕਦੇ ਹੋ ਮਤਲਬ ਦਿਲ ਖੁਸ਼ ਹੋ ਜਾਣਾ ਤੁਹਾਡਾ ਜਗ੍ਹਾ ਦੇਖਣ ਵਾਲੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਮੈਨੂੰ ਵੈਸੇ ਅਗਲੇ ਮਹੀਨੇ ਛੁੱਟੀਆਂ ਆ ਰਹੀਆਂ ਦੋ ਤਿੰਨ ਅਤੇ ਕੋਈ ਨਹੀਂ ਮੈਂ ਟਾਈਮ ਕੱਢ ਕੇ ਤੁਹਾਨੂੰ ਮਤਲਬ ਕੋਈ ਨਹੀਂ ਲੈ ਜਾਂਗਾ ਕੋਈ ਚੱਕਰ ਨਹੀਂ ਬਾਕੀ ਤੁਸੀਂ ਇੱਕ ਸਾਡੇ ਇੱਧਰ ਅਨੰਦਪੁਰ ਸਾਹਿਬ ਵੀ ਹੈ ਜਗ੍ਹਾ ਹੈਗੀ ਉੱਥੇ ਗੁਰ ਹਾਂਜੀ ਹਾਂਜੀ ਉੱਥੇ ਵੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਹ ਵੀ ਮਤਲਬ ਬ ਹਾਂਜੀ ਹਾਂਜੀ ਉਹ ਵੀ ਗੁਰਦੁਆਰਾ ਦੇਖਣ ਵਾਲਾ ਉਹਦੇ ਨਾਲ ਉਹਨਾਂ ਨੇ ਅਜੂਬਾ ਮਤਲਬ ਸਾਡੀ ਗੌਰਮੈਂਟ ਨੇ ਮਿਲ ਕੇ ਨਾ ਉੱਥੇ ਅਜੂਬਾ ਬਣਾਇਆ ਵਾ ਜੀ ਮਤਲਬ ਉਹ ਅਜੂਬਾ ਮਤਲਬ ਦੇਖਣਾ ਲਈ ਉੱਥੇ ਵੀ ਮਤਲਬ ਉਹ ਚੀਜ਼ ਵੀ ਲੋਕ ਦੂਰ ਦੂਰ ਤੋਂ ਦੇਖਣ ਆਉਂਦੇ ਆ ਮਤਲਬ ਦਿਲ ਖੁਸ਼ ਹੋ ਜਾਂਦਾ ਜੀ ਬੰਦਾ ਜੇ ਆਹ ਦੇਖ ਲਏ ਅਜੂਬਾ ਹਾਂਜੀ ਹਾਂਜੀ ਉਹੀ ਦੱਸ ਰਿਹਾ ਅਨੰਦਪੁਰ ਸਾਹਿਬ ਈ ਹੈ ਜੀ ਅਨੰਦਪੁਰ ਸਾਹਿਬ ਜਿਹੜੇ ਗੁਰਦੁਆਰਾ ਨਾ ਉਹਦੇ ਨਾਲ ਹੀ ਅਜੂਬਾ ਜੀ ਪਹਿਲਾਂ ਤੁਸੀਂ ਗੁਰਦੁਆਰੇ ਹਾਂਜੀ ਗੁਰਦੁਆਰੇ ਚੱਲੇ ਜੋ ਨਾਲੇ ਤੁਹਾਡੇ ਅਜੂਬਾ ਜੀ ਉਹ ਦੇਖ ਲਿਓ ਮਤਲਬ ਤੁਸੀਂ ਆਏ ਤੁਸੀਂ ਜਿੱਥੋਂ ਮਰਜੀ ਆ ਤੁਹਾਡੇ ਪੈਸੇ ਵਸੂਲ ਹੋ ਜਾਣੇ ਉਹ ਦੇਖਣ ਵਾਲੀ ਜਗ੍ਹਾ ਹੈ ਹਾਂਜੀ ਹਾਂਜੀ ਉਹ ਬਸ ਜਿਹੜਾ ਤੁਹਾਨੂੰ ਦੱਸਿਆ ਨਾ ਹਰਿਮੰਦਰ ਸਾਹਿਬ ਗੁਰਦੁਆਰਾ ਜੀ ਉਹਦੇ ਨਾਲ ਹੀ ਹੈ ਜੀ ਥੋੜ੍ਹਾ ਹੀ ਦੂਰ ਹੈ ਮਤਲਬ ਮੇਰੇ ਖਿਆਲ ਤੋਂ ਪੰਜ ਸੌ ਪੰਜ ਸੌ ਮੀਟਰ ਚੱਲ ਤੁਰ ਕੇ ਨਾ ਨਾਲ ਹੀ ਹੈ ਜਲਿਆਂਵਾਲਾ ਬਾਗ ਉਹ ਵੀ ਮਤਲਬ ਜਗ੍ਹਾ ਦੇਖਣ ਵਾਲੀ ਹੈ ਹਿਸਟੋਰੀਕਲ ਪਲੇਸ ਹੈ ਜੀ ਮਤਲਬ ਵਧੀਆ ਮਤਲਬ ਦੇਖਣ ਵਾਲੀ ਜਗ੍ਹਾ ਜੀ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਅਗਲੇ ਮਹੀਨੇ ਨਾ ਮਤਲਬ ਜਿਹਦੇ ਵੀ ਛੁੱਟੀਆਂ ਹੋਈਆਂ ਮੈਂ ਤੁਹਾਨੂੰ ਕੋਲ ਕਰ ਲਾਂਗਾ ਇਸ ਨੰਬਰ 'ਤੇ ਫਿਰ ਚਲੋ ਕੋਈ ਨਹੀਂ ਤੁਸੀਂ ਚੱਲ ਪਿਓ ਮੈਂ ਤੁਹਾਨੂੰ ਘੁੰਮਾ ਲਿਆਵਾਂਗੇ ਪੰਜਾਬ 'ਚ ਜਿਹੜੀ ਜਿਹੜੀ ਜਗ੍ਹਾ ਤੁਸੀਂ ਦੇਖਣੀ ਓਕੇ ਠੀਕ ਹੈ